ਹਾਂ ਮੈਨੂੰ ਇੱਕ ਚੁਣੌਤੀ ਦਾ ਸਾਹਮਣਾ ਸਾਹਮਣਾ ਕਰਨਾ ਪਿਆ ਸੀ ਜਦੋਂ ਕਰੋਨਾ ਵਾਇਰਸ ਚੱਲ ਰਿਹਾ ਸੀ ਤਾਂ ਓਸ ਸਮੇਂ ਲੋਕਡਾਊਨ ਹੋ ਚੁੱਕਾ ਸੀ ਤਾਂ ਬਾਹਰੋਂ ਆਉਣਾ ਜਾਣਾ ਵੀ ਬੰਦ ਹੋ ਚੁੱਕਿਆ ਸੀ ਉਸ ਸਮੇਂ ਮੇਰੇ ਬੇਟੇ ਦਾ ਬਰਡੇ ਸੀ ਤਾਂ ਉਹ ਜਿੱਦ ਕਰਨ ਲੱਗ ਗਿਆ ਕਿ ਮੰਮਾ ਮੈਂ ਕੇਕ ਕੱਟਣਾ ਹੀ ਕੱਟਣਾ ਹੈ ਤਾਂ ਮੇਰੇ ਲਈ ਕੇਕ ਲਿਆਓ ਤਾਂ ਬਾਹਰੋਂ ਬਹੁਤ ਜ਼ਿਆਦਾ ਸਮਾਨ ਲਿਆਉਣ ਕੇਕ ਲਿਆਉਣ ਵਿੱਚ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ ਕੀ ਕਰੋਨਾ ਵਾਇਰਸ ਨਾ ਹੋ ਜਾਏ ਤਾਂ ਮੈਂ ਇੱਕ ਬੱਚੇ ਦੀ ਜਿੱਦ ਪੂਰੀ ਕਰਨ ਵਾਸਤੇ ਤਾਂ ਇੱਕ ਉਹ ਉਹ ਕਰਿਆ ਤਾਂ ਘਰ ਤੋਂ ਹੀ ਸਮਾਨ ਇਕੱਠਾ ਕਰਕੇ ਹੋਮਮੇਡ ਕੇਕ ਤਿਆਰ ਕੀਤਾ ਉਹ ਕੇਕ ਕੇਕ ਉਹ ਮੈਂ ਤਿਆਰ ਕ ਕੀਤਾ ਅਤੇ ਉਹ ਕੇਕ ਤਿਆਰ ਕਰਕੇ ਇੰਨਾਂ ਵਧੀਆ ਲੱਗਿਆ ਅਤੇ ਮੇਰੇ ਬੇਟੇ ਦਾ ਬਰਡੇ ਸੈਲੀਬਰੇਟ ਕੀਤਾ ਅਸੀਂ ਘਰ ਵਿੱਚ ਹੀ ਤਾਂ ਇਹ ਮੈਨੂੰ ਅਚਾਨਕ ਹੀ ਬੇਟੇ ਦੀ ਜਿੱਦ ਪੂਰੀ ਕਰਨ ਲਈ ਕੇਕ ਬਣਾਉਣਾ ਪਿਆ ਤਾਂ ਉਹ ਕੇਕ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਅਤੇ ਸ਼ੁੱਧ ਹੋਣਾ ਹੀ ਸੀ ਕਿਉਂ ਬਾਹਰਲੀਆਂ ਚੀਜ਼ਾਂ ਵਿੱਚ ਬਹੁਤ ਜ਼ਿਆਦਾ ਮਿਲਾਵਟ ਹੁੰਦੀ ਹੈ ਤਾਂ ਓਹ ਬਿਨਾਂ ਮਿਲਾਵਟ ਤੋਂ ਆਪਣੇ ਹੱਥੀਂ ਤਿਆਰ ਕੀਤਾ ਗਿਆ ਇਹ ਕੇਕ ਤਾਂ ਮੇਰਾ ਬੇਟਾ ਵੀ ਬਹੁਤ ਜ਼ਿਆਦਾ ਖੁਸ਼ ਹੋਇਆ ਅਤੇ ਉਹ ਕੇਕ ਅਸੀਂ ਨੇ ਸਾਰਿਆਂ ਨੇ ਰਲ ਮਿਲ ਕੇ ਕੱਟਿਆ ਅਤੇ ਖਾਧਾ ਅਤੇ ਬਰਡੇ ਸੈਲੀਬਰੇਟ ਕੀਤਾ